ਨਹੀਂ ਸਾਨੂੰ ਪੰਜਾਬੀ ਲਿਖਣ ਜਾਂ ਬੋਲਣ ਵਿੱਚ ਕਦੀ ਵੀ ਕੋਈ ਮੁਸ਼ਕਿਲ ਨਹੀਂ ਆਈ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਪੰਜਾਬੀ ਬੋਲੀ ਸਾਡੇ ਘਰਾਂ ਵਿੱਚ ਬੋਲੀ ਜਾਂਦੀ ਹੈ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਵੀ ਹੀ ਪੰਜਾਬੀ ਬੋਲੀ ਬੋਲਦੇ ਹਾਂ ਸਕੂਲ ਦੇ ਵਿੱਚ ਟੀਚਰ ਜਿਹੜੇ ਹੈ ਪੰਜਾਬ ਬੋਰਡ ਸਕੂਲਾਂ ਦੇ ਉਹ ਪੰਜਾਬੀ ਦੀ ਵਿੱਚ ਹੀ ਗੱਲ ਕਰਦੇ ਹੈ ਸਾਡੇ ਜ਼ਿਆਦਾਤਰ ਜਿਹੜੇ ਸਬਜੈਕਟ ਹੈ ਉਹ ਪੰਜਾਬੀ ਦੇ ਵਿੱਚ ਹੁੰਦੇ ਹੈ ਇਸ ਕਰਕੇ ਸਾਨੂੰ ਪੰਜਾਬੀ ਲਿਖਣ ਅਤੇ ਬੋਲਣ ਵਿੱਚ ਕਦੇ ਵੀ ਕੋਈ ਦਿੱਕਤ ਨਹੀਂ ਆਈ